ਭਾਰਤ ਵਿੱਚ ਬਹੁਤ ਤਰੀਕਿਆਂ ਦੇ ਭੋਜਨ ਖਾਧੇ ਜਾਂਦੇ ਹਨ ਜੇਕਰ ਆਪਾਂ ਇਨ੍ਹਾਂ ਵਿੱਚੋਂ ਗੱਲ ਕਰੀਏ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮੱਕੀ ਦੀ ਰੋਟੀ ਦੇ ਨਾਲ਼ ਸਰ੍ਹੋਂ ਦਾ ਸਾਗ ਬਹੁਤ ਹੀ ਪ੍ਰਸਿੱਧ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਔਰਤਾਂ ਜਾਂਦੀਆਂ ਹਨ ਖੇਤ ਦੇ ਵਿੱਚ ਅਤੇ ਉੱਥੋਂ ਸਾਗ ਨੂੰ ਚੁੱਗਦੀਆਂ ਹਨ ਅਤੇ ਧੋ ਸੁਆਰ ਕੇ ਘਰ ਲਿਜਾ ਕੇ ਬਣਾਉਂਦੀਆਂ ਹਨ ਅਤੇ ਇਸ ਦਾ ਸੁਆਦ ਬਣਾਉਣ ਲਈ ਤੜਕਾ ਲਾਇਆ ਜਾਂਦਾ ਹੈ ਅਤੇ ਜਿਸ ਨਾਲ਼ ਸਾਗ ਦੀ ਸੁਆਦਿਸ਼ਟ ਹੋਰ ਵੀ ਵੱਧ ਜਾਂਦੀ ਹੈ ਇਸ ਨੂੰ ਸਾਰੇ ਬੜੇ ਚਾਵਾਂ ਨਾਲ਼ ਖਾਂਦੇ ਹਨ ਅਤੇ ਜਿਸ ਕਰਕੇ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਮੰਨਿਆ ਜਾਂਦਾ ਹੈ ਅਤੇ ਵਰਤੇੇ ਜਾਣ ਵਾਲ਼ੇ ਪ੍ਰਸਿੱਧ ਪਕਵਾਨ ਜਿਵੇਂ ਕਿ ਸਮੌਸਾ ਇਹ ਇਸ ਦੀ ਵਰਤੋਂ ਰੋਜ਼ਾਨਾ ਹੁੰਦੀ ਹੈ ਅਤੇ ਮਸਾਲਿਆਂ ਦੀ ਗੱਲ ਕਰੀਏ ਤਾਂ ਕੜ੍ਹੀ ਪੱਤਾ ਧਨੀਆ ਮੇਥੇ ਆਦਿ ਇਹ ਨਿੱਜੀ ਰੋਜ਼ਾਨਾ ਵਰਤੇ ਜਾਂਦੇ ਹਨ ਧੰਨ ਓਕਾ